ਮੇਰਾ ਅਨੁਭਵ ਕਿਸੇ ਸਮੂਹ ਦੇ ਨਾਲ ਦੌੜਦੇ ਹੋਏ ਬਹੁਤ ਜ਼ਿਆਦਾ ਵਧੀਆ ਸੀ ਜਦੋਂ ਮੈਂ ਸਕੂਲ ਵਿੱਚ ਪ ਪੜ੍ਹਦੀ ਸੀ ਤਾਂ ਉਸ ਟਾਈਮ ਸਾਡੇ ਖੇਡਾਂ ਖੇਡਾਂ ਦਾ ਪੀਰੀਅਡ ਲੱਗਦਾ ਸੀ ਜਿਸ ਵਿੱਚ ਮੈਂ ਦੋੜਾਂ ਵਿੱਚ ਸੀ ਸ਼ੁਰੂ ਸ਼ੁਰੂ ਤੋਂ ਮੈਨੂੰ ਲੱਗਦਾ ਸੀ ਕਿ ਮੈਂ ਦੌੜ ਨਹੀਂ ਸਕਦੀ ਕਿਉਂਕਿ ਕਦੇ ਮੈਂ ਇਹ ਇਹ ਖੇ ਖੇਡਾਂ ਖੇਡੀਆਂ ਨਹੀਂ ਸੀ ਪਰ ਹੌਲੀ ਹੌਲੀ ਜਦੋਂ ਮੈਂ ਇਸ ਕਲੱਬ ਉੱਤੇ ਸਮੂਹ ਨਾਲ ਜੁੜੀ ਤਾਂ ਮੈਨੂੰ ਪਤਾ ਲੱਗਿਆ ਵੀ ਮੈਂ ਮੈਂ ਵੀ ਦੌੜ ਸਕਦੀ ਹਾਂ ਜਿਸ ਨਾਲ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਹੌਲੀ ਹੌਲੀ ਜਦੋਂ ਮੇਰਾ ਸਟੈਮਿਨਾਰ ਵਧਿਆ ਅਤੇ ਸਾਡੀ ਟੀ ਟੀਮ ਹੌਲੀ ਹੌਲੀ ਜਦੋਂ ਮੇਰਾ ਸਟੈਮੀਨਾਰ ਵਧਿਆ ਅਤੇ ਮੇਰਾ ਖੇਡਾਂ ਵਿੱਚ ਪ੍ਰਦਰਸ਼ਨ ਵੀ ਬਹੁਤ ਜ਼ਿਆਦਾ ਚੰਗਾ ਹੋਇਆ ਖੇਡਾਂ ਦੇ ਨਾਲ ਨਾਲ ਸਾਡਾ ਸਰੀਰਕ ਵਿਕਾਸ ਤਾਂ ਹੁੰਦਾ ਹੀ ਹੈ ਪਰ ਜਿਸ ਨਾ ਪਰ ਹੌਲੀ ਹੌਲੀ ਸਾਡਾ ਮਾਨਸਿਕ ਵਿਕਾਸ ਵੀ ਹੁੰਦਾ ਜਿਸ ਨਾਲ ਅਸੀਂ ਲੋਕਾਂ ਨਾਲ ਵੇ ਕਿਵੇਂ ਵਿਚਰਨਾ ਹੈ ਉਹਨਾਂ ਨਾਲ ਕਿਵੇਂ ਗੱਲਬਾਤ ਕਰਨੀ ਹੈ ਅਤੇ ਸਾਡੇ ਵਿੱਚ ਇੱਕ ਲੀਡ ਲੀਡਰਸ਼ਿਪ ਕੁਆਲਿਟੀ ਆਉਂਦੀ ਹੈ ਅਤੇ ਕਿਸੇ ਵੀ ਸਮੂਹ ਨਾਲ ਜੁੜਣ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਨਾਲ ਦੇ ਖਿਡਾਰੀਆਂ ਨਾਲ ਕਿਵੇਂ ਤਾਲਮੇਲ ਬਣਾ ਕੇ ਚੱਲਣਾ ਚਾਹੀਦਾ ਹੈ ਜੋ ਕਿ ਬਾਤ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਸਾਡੇ ਸਕੂਲ ਵਿੱਚ ਦੌੜਾਂ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਸੀ ਅਤੇ ਅਸੀਂ ਸੌ ਮੀ ਸੌ ਸੌ ਮੀਟਰ ਦੌੜ ਦੋ ਸੌ ਮੀਟਰ ਇਹ ਅਸੀਂ ਖੇਡੀਆਂ ਹਨ ਜੋ ਕਿ ਬਹੁਤ ਮੈਨੂੰ ਵਧੀਆ ਲੱਗਦੀਆਂ ਹਨ ਜਿਸ ਨਾਲ ਮੇਰਾ ਮਾਨਸਿਕ ਅਤੇ ਸਰੀਰਿਕ ਵਾ ਵਿਕਾਸ ਹੋਇਆ ਹੈ ਦੋੜਾਂ ਵਿੱਚ ਮੇਰਾ ਅਨੁਭਵ ਬਹੁਤ ਜ਼ਿਆਦਾ ਵਧੀਆ ਰਿਹਾ ਹੈ ਜਿਸ ਨੇ ਮੈਨੂੰ ਹਰੇਕ ਫੀਲਡ ਵਿੱਚ ਬਹੁਤ ਜ਼ਿਆਦਾ ਸਹਾਇਤਾ ਕੀਤੀ ਹੈ